ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁੱਲ ਜੀ ਮੈਕਸੀਮਮ ਜੀ ਮਤਲਬ ਪੰਜ ਹਜ਼ਾਰ ਤੋਂ ਉੱਤੇ ਹੁੰਦਾ ਜੀ ਉਹ ਸ਼ਹਿਰਾਂ ਦੇ ਹਿਸਾਬ ਨਾਲ਼ ਹੁੰਦਾ ਜਿੱਥੇ ਜਿੱਥੇ ਵੀ ਜਾਣਾ ਉਹਦੇ ਹਿਸਾਬ ਨਾਲ਼ ਅਲੱਗ ਅਲੱਗ ਪੈਕਿਜ ਹੁਦੇ ਹੈ ਜੀ ਜਿਸ ਤਰ੍ਹਾਂ ਜੀ ਆਪਣੇ ਦਰਬਾਰ ਸਾਹਿਬ ਹੈ ਗੌਲਡਨ ਟੈਂਪਲ ਜਿੱਥੇ ਕੀ ਦੇਸ਼ਾਂ ਵਿਦੇਸ਼ਾ ਤੋਂ ਵੀ ਦੁਨੀਆ ਆਉਂਦੀ ਤੁਹਾਨੂੰ ਪਤਾ ਹੋਏਗਾ ਉਹਦੇ ਬਾਰੇ ਉਹ ਦੇਖ ਸਕਦੇ ਆਪਾਂ ਹਾਂਜੀ ਉਹ ਦੇਖਣ ਆਲੀ ਜਗ੍ਹਾ ਹੈ ਸਾਇੰਸ ਸਿਟੀ ਦੇਖ ਸਕਦੇ ਆ ਜੀ ਜਲੰਧਰ ਆਪਾਂ ਰਸਤੇ ਦੇ ਵਿੱਚ ਆਉਂਦੀ ਹੈ ਹਾਂਜੀ ਉਹਤੋਂ ਬਾਅਦ ਆਪਾਂ ਅੱਗੇ ਇੱਕ ਤਾਂ ਬਾਗਹਾ ਬਾਡਰ ਹੋ ਗਿਆ ਜੀ ਜਿੱਥੇ ਪਰੇਡ ਹੁੰਦੀ ਹੈ ਇੰਡੀਆ ਔਰ ਪਾਕਿਸਤਾਨ ਦੇ ਜਵਾਨਾਂ ਦੀ ਉਹ ਆਪਾਂ ਤੁਹਾਨੂੰ ਦਿਖਾ ਸਕਦੇ ਆ ਜੀ ਹੋਰ ਵੀ ਉਧਰ ਜਿੰਨ੍ਹੇ ਵੀ ਇਤਿਹਾਸਿਕ ਸਥਾਨ ਹੈ ਜਾਂ ਗੁਰੂ ਘਰ ਰਿਲੇਟਿਵ ਰਿਲੇਟਿਵ ਹੈ ਜਾਂ ਈ ਹੋਰ ਹੈ ਸਾਰੇ ਆਪਾਂ ਦਿਖਾ ਸਕਦੇ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਜਿੱਥੇ ਜਿੱਥੇ ਵੀ ਜਾਵਾਂਗੇ ਜੀ ਰਹਿਣ ਦਾ ਪ੍ਰਬੰਧ ਮਤਲਬ ਕੀ ਸਾਡੇ ਵੱਲੋਂ ਸਾਰੀ ਲੈਂਨੇ ਐ ਜੀ ਸੇਵਾ ਤਾਂ ਉਹ ਉਹਦੇ ਵਿੱਚ ਘੱਟ ਤੋਂ ਘੱਟ ਤੁਹਾਨੂੰ ਪੰਦਰਾਂ ਵੀਹ ਹਜ਼ਾਰ ਦੇ ਵਿੱਚ ਵਿੱਚ ਖਰਚਾ ਆਏਗਾ ਜੀ ਗਾਈਡ ਕਰਨ ਦਾ ਵੀ ਮਤਲਬ ਰਹਿਣ ਰਹੂਣ ਦਾ ਵੀ ਵਿੱਚੇ ਪਬਲਿਕ ਦਾ ਵੀ ਵਿੱਚੇ ਜੀ ਉਹਦੇ ਵਿੱਚ ਤੁਹਾਨੂੰ ਪ ਪਲੇਸਿਜ਼ ਦੱਸ ਦਿੱਤੇ ਜਾਣਗੇ ਜੀ ਥੋੜੇ ਕੁ ਵੀ ਇਹ ਇਹ ਪਲੇਸਿਜ਼ ਦੇ ਵਿੱਚ ਆਪਾਂ ਨੇ ਜਾਣਾ ਹੈ ਉਹ ਹਿਸਾਬ ਨਾਲ਼ ਹੈ ਤੁਹਾਨੂੰ ਫਿਰ ਖਰਚਾ ਆਏਗਾ ਜੀ ਤੁਹਾਡਾ ਹਾਂਜੀ ਹਾਂਜੀ ਤੁਸੀਂ ਮਤਲਬ ਜਾਣਾ ਕਿੱਥੇ ਚਾਹੁੰਦੇ ਜੀ ਨਹੀਂ ਜਾਣਾ ਕਿੱਥੇ ਚਾਹੁੰਦੇ ਜੀ ਤੁਸੀਂ ਹਾਂਜੀ ਹਾਂਜੀ ਹਾਂਜੀ ਸ਼ਹੀਦ ਭਗਤ ਸਿੰਘ ਜੀ ਦਾ ਪਿੰਡ ਖਟਖੜ ਕਲਾ ਅਜਾਇਬ ਘਰ ਉੱਥੇ ਉਹ ਦਿਖਾਦਾਗੇ ਤੁਹਾਨੂੰ ਇੱਕ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ